ਮੈਂ ਗੁਰਦਾਸਪੁਰ ਤੋਂ ਹਰਜੀਤ ਕੌਰ ਬੋਲਦੀ ਪਈ ਹਾਂ ਸਤਿ ਸ਼੍ਰੀ ਅਕਾਲ ਜੀ ਟੈਕਨੋਲੋਜੀ ਜੀ ਟੈਕਨੋਲੋਜੀ ਤਾਂ ਅੱਜ ਕੱਲ੍ਹ ਇੰਨੀ ਕੁ ਮਤਲਬ ਕਿ ਹੋ ਗਿਆ ਵਾ ਕੰਮ ਕਿ ਹਰ ਚੀਜ਼ ਅਸੀਂ ਘਰ ਬੈਠਿਆ ਬਿਠਾਇਆ ਆਨਲਾਈਨ ਮੰਗਵਾ ਸਕਦੇ ਹਾਂ ਜਿੱਦਾਂ ਹੁਣ ਕਿਤੇ ਯਾਤਰਾ 'ਤੇ ਵੀ ਜਾਣਾ ਹੋਵੇ ਘਰੋਂ ਹੀ ਟਿਕਟਾਂ ਬੁੱਕ ਕਰਾ ਲਈਦੀਆਂ ਵਾ ਜਦੋਂ ਵੇਖਿਆ ਵੀ ਕੋਈ ਜਿੱਦਾਂ ਕੋਈ ਬੱਚਾ ਬਾਹਰ ਗਿਆ ਵਾ ਜਾਂ ਕੁਛ ਵੀ ਗਿਆ ਵਾ ਉਥੋਂ ਅਸੀਂ ਇਹਨਾਂ ਨੂੰ ਪਤਾ ਕਰ ਸ ਸਕ ਲੈਦੇ ਹਾਂ ਕਰ ਸਕਦੇ ਹਾਂ ਟੈਕਨੋਲੋਜੀ ਇੰਨੀ ਕੁ ਵੱਧ ਗਈ ਆ ਕਿ ਉਹਦੀ ਲੋਕੇਸ਼ਨ ਦਾ ਸਾਨੂੰ ਹਰ ਚੀਜ਼ ਦਾ ਪਤਾ ਚੱਲ ਜਾਂਦਾ ਆ ਕਿ ਬੱਚਾ ਕਿੱਥੇ ਝੱਟ ਫੋਨ ਕਰ ਦਿੰਦੇ ਆ ਕਿ ਇੱਥੇ ਆ ਰਹੇ ਹਾਂ ਇੱਥੇ ਹੈਗੇ ਹਾਂ ਅਤੇ ਅਤੇ ਬਾਕੀ ਜਿਹੜੀ ਹੈਗੀ ਆ ਕਿ ਹੋਟਲਾਂ ਦੇ ਜਿਹੜੀ ਅੱਜ ਕੱਲ੍ਹ ਇੰਨੀ ਤਕਨੀਕ ਹੋ ਗਈ ਆ ਕਿ ਅਸੀਂ ਘਰ ਬੈਠੇ ਹੋਟਲ ਬੁੱਕ ਕਰਾ ਸਕਦੇ ਆ ਹਵਾਈ ਜਹਾਜ਼ ਕਿਤੇ ਜਾਣਾ ਹੋਵੇ ਉਹਦੀਆਂ ਟਿਕਟਾਂ ਬੁੱਕ ਕਰਾ ਸਕਦੇ ਹਾਂ ਅਤੇ ਅਤੇ ਕੁਛ ਵੀ ਮਤਲਬ ਕਿ ਕਰਨਾ ਹੋਵੇ ਅਤੇ ਬਸਾਂ ਦੇ ਵਿੱਚ ਬੱਸਾਂ ਦਾ ਵੀ ਪਤਾ ਚੱਲ ਜਾਂਦਾ ਵਾ ਭੀ ਕਿੰਨੇ ਮਤਲਬ ਕਿ ਘਰੋਂ ਬੈਠੇ ਹੀ ਆਨਲਾਈਨ ਟਿਕਟਾਂ ਬੁਕਿੰਗ ਵੀ ਕਰਾ ਸਕਦੇ ਆ ਅਤੇ ਬਾਕੀ ਹਨ ਇੰਨਾਂ ਵੀ ਹੁਣ ਇਹਨੀ ਕੁ ਟੈਕਨੋਲੋਜੀ ਵੱਧ ਗਈ ਆ ਕਿ ਅਸੀਂ ਟ੍ਰੇਨਾਂ ਤੋਂ ਵੀ ਪਤਾ ਲਾਂਦੇ ਟ੍ਰੇਨ ਕਿਸੇ ਮਤਲਬ ਕਿ ਜਗ੍ਹਾ 'ਤੇ ਆ ਰਹੀ ਹੈ ਮੋਬੈਲਾ ਰਾਹੀਂ ਹਰ ਚੀਜ਼ ਉਥੋਂ ਹੀ ਵੇਖ ਸਕਦੇ ਆ ਕਿ ਇੱਕ ਮਤਲਬ

ਇੱਥੇ ਹੀ ਫਿਰ ਮੌਸਮ ਇੰਨੀ ਕੁ ਟੈਕਨੋਲੋਜੀ ਆ ਕੀ ਮੌਸਮ ਦੀ ਜਾਣਕਾਰੀ ਵੀ ਵੇਖ ਸਕਦੇ ਆ ਭੀ ਅੱਜ ਬਾਰਿਸ਼ ਆ ਕੀ ਅੱਜ ਜਾਂ ਹਨੇਰ ਚੱਖੜ ਜਾਂ ਕੁਛ ਵੀ ਆ ਜਿੱਦਾਂ ਮਤਲਬ ਮੌਸਮ ਖਰਾਬ ਹੋਵੇ ਵੀ ਸਾਨੂੰ ਪਤਾ ਚੱਲ ਜਾਂਦਾ ਈ ਆਪਣਾ ਜੋ ਵੀ ਘਰ ਦਾ ਕੰਮ ਕਾਰ ਆ ਉਹਨੂੰ ਅਸੀਂ ਜਲਦੀ ਕਰ ਲੈਂਦੇ ਹਾਂ ਅਤੇ ਅਤੇ ਹਰ ਚੀਜ਼ ਮਤਲਬ ਕਿ ਇੰਨਾਂ ਕੁ ਟੈਕਨੋਲੋਜੀ ਹੈ ਕਿ ਹਰ ਚੀਜ਼ ਘਰ ਬੈਠੇ ਆ ਜਿੱਦਾਂ ਹੁਣ ਬੱਚਿਆਂ ਨੇ ਕੁਛ ਬਾਹਰੋਂ ਖਾਣਾ ਮੰਗਾਉਣਾ ਹੋਵੇ ਉਹ ਆਪਣਾ ਘਰੋਂ ਹੀ ਖਾਣਾ ਬੁੱਕ ਕਰਵਾ ਕੇ ਕ ਘਰੋਂ ਹੀ ਮੰਗਵਾ ਸਕਦੇ ਨੇ ਜੋ ਜਿੱਦਾਂ ਵੀ ਉਹਨਾਂ ਨੇ ਕੋਈ ਕੰਮ ਕਾਰ ਕਰਨਾ ਹੋਵੇ ਤਾਂ ਉਹ ਆਪਣੇ ਆਨਲਾਈਨ ਸਾਰਾ ਹੀ ਕੰਮ ਕਰ ਸਕਦੇ ਕਰ ਸਕਦੇ ਆ ਅਤੇ ਇ ਇੰਨੀ ਮਤਲਬ ਕਿ ਹੈਗੀ ਕਿ ਜਿੱਦਾਂ ਹੁਣ ਮਸ਼ੀਨਾਂ ਕੱਪੜੇ ਧੋਣ ਵਾਲੀਆਂ ਵੀ ਆ ਗਈਆਂ ਵੀ ਟੈਕਨੋਲੋਜੀ ਇਵੇਂ ਉਹਦੇ ਨਾਲ ਹੱਥ ਨਾਲ ਗਿਲ ਕੇ ਹੱਥ ਨਾਲ ਕੱਪੜੇ ਧੋਂਦੇ ਹੀ ਹੋਣ ਅਸੀਂ ਮਸ਼ੀਨਾਂ ਦੇ ਨਾਲ ਵੀ ਕੱਪੜੇ ਧੋਣ ਲੱਗ ਪਏ ਅਤੇ ਜਿਹੜੇ ਹੈਗੇ ਆ ਜਿਹੜਾ ਸਫਰ ਕਰਨਾ ਵਾ ਹਵਾਈ ਜਹਾਜ਼ ਜਾਂ ਕਿਸ ਤਰ੍ਹਾਂ ਵੀ ਉਹ ਵੀ ਘਰੋਂ ਹੀ ਬੈਠੇ ਬਿਠਾਏ ਸਾਰਾ ਕੁਛ ਹੀ ਬੁੱਕ ਕਰ ਸਕਦੇ ਹਾਂ